ਸਾਡੀ ਰਸੋਈ ਵਿੱਚ ਵੱਖ ਵੱਖ ਤਰ੍ਹਾਂ ਦੇ ਬਰਤਨ ਹਨ ਜਿਵੇਂ ਸਾਰਿਆਂ ਦੀ ਰਸੋਈ ਵਿੱਚ ਹੁੰਦੇ ਨੇ ਜਿਵੇਂ ਕੜਛੀ ਤੂਸੱਗ ਚਾਹ ਛਾਨਣੀ ਵੇਲਣਾ ਚਕਲਾ ਤਵਾ ਅਤੇ ਹੋਰ ਵੀ ਆਦਿ ਅਤੇ ਪਰ ਮੇਰਾ ਜਿਹੜਾ ਸਭ ਤੋਂ ਪਸੰਦੀਦਾ ਜਾਂ ਕਹਿ ਸਕਦੇ ਹੋ ਜ਼ਿਆਦਾ ਵਰਤਣ ਵਾਲਾ ਭਾਂਡਾ ਓਹ ਹੈਗਾ ਹੈ ਟੱਬੂ ਕਿਉਂਕਿ ਅਸੀਂ ਉਹਦੇ ਵਿੱਚ ਚਾਹ ਬਣਾਨੇ ਹਾਂ ਚਾਹ ਅਤੇ ਫਿਰ ਸਰ ਵੈਸੇ ਵੀ ਸਰਦੀਆਂ 'ਚ ਬਹੁਤ ਵਾਰ ਬਣਦੀ ਆ ਅਤੇ ਪੰਜਾਬ ਦੇ ਲੋਕ ਤਾਂ ਗਰਮੀਆਂ 'ਚ ਵੀ ਸਾਰਾ ਦਿਨ ਬਣਾ ਕੇ ਪੀਈ ਜਾਂਦੇ ਨੇ ਜਿਹੜੀ ਸਾਡੀ ਰਸੋਈ ਆ ਓਹ ਛੋਟੀ ਜੀ ਹੈ ਪਰ ਬਹੁਤ ਸੋਹਣੀ ਹੈ ਉਹ 'ਤੇ ਟਾਇਲਾਂ ਲੱਗੀਆਂ ਹੋਈਆਂ ਨੇ ਅਤੇ ਮੈਂ ਹਮੇਸ਼ਾਂ ਉਹਦਾ ਬਹੁਤ ਧਿਆਨ ਰੱਖਦੀ ਹਾਂ ਅਤੇ ਉਹਨੂੰ ਸਾਫ ਵੀ ਰੱਖਦੀ ਹਾਂ ਜਿਹੜੀਆਂ ਉਹ ਟਾਈਲਾਂ ਨੇ ਮੈਂ ਮਾੜਾ ਜਾ ਵੀ ਗੰਦ ਨਹੀਂ ਜੰਮਣ ਦਿੰਦੀ ਉਹਦੇ ਉਹਦੇ 'ਤੇ ਅਤੇ ਫਿਰ ਮੈਂ ਮਤਲਬ ਆਪਣੇ ਘਰ 'ਚੋਂ ਸਭ ਦਾ ਧਿਆਨ ਰੱਖਦੀ ਹਾਂ ਅਤੇ ਓਹ ਜਿਹੜੇ ਭਾਂਡੇ ਨੇ ਉਹਨਾਂ ਨੂੰ ਧਿਆਨ ਨਾਲ ਰੱਖਦੀ ਹਾਂ ਅਤੇ ਕੋਈ ਵੀ ਜਿਵੇਂ ਸਾਡੇ ਓਹ 'ਚ ਕੰਚ ਦੇ ਗਲਾਸ ਨੇ ਹੋਰ ਕੁਛ ਆ ਉਹਨਾਂ ਨੂੰ ਵੀ ਮਾੜਾ ਜਾ ਟੁੱਟਣ ਨਹੀਂ ਦਿੰਦੀ ਮਤਲਬ ਸਾਡੇ ਰਸੋਈ 'ਚ ਅਲੱਗ ਅਲੱਗ ਤਰ੍ਹਾਂ ਦੇ ਕੱਪ ਗਲਾਸ ਕੋਲੀਆਂ ਚਮਚੇ ਕੰਚ ਦੇ ਸਟੀਲ ਦੇ ਪਿੱਤਲ ਦੇ ਵੀ ਹੈਗੇ ਨੇ ਅਤੇ ਅਲੱਗ ਅਲੱਗ ਤਰੀਕੇ ਦੇ ਨੇ ਅਤੇ ਮੈਂ ਸਾਰੀ ਚੀਜ਼ਾਂ ਦਾ ਇੱਦਾਂ ਹੀ ਧਿਆਨ ਰੱਖਦੀ ਹਾਂ ਜਿਵੇਂ ਮੈਂ ਖੁਦ ਦਾ ਰੱਖਦੀ ਹਾਂ ਤਾਂ ਕਿ ਓਹ ਚੀਜ਼ਾਂ ਨੂੰ ਕੋਈ ਚੋਟ ਨਾ ਪਹੁੰਚੇ ਅਤੇ ਇੱਕ ਸਾਡੇ ਘਰ ਜਿਹੜੀ ਕੜਾਹੀ ਆ ਓਹ ਵੀ ਬਹੁਤ ਵਰਤੀ ਜਾਂਦੀ ਕਿਉਂਕਿ ਅਸੀਂ ਉਹ 'ਚ ਖਾਣਾ ਬਣਾਨੇ ਹਾਂ ਮੰਮੀ ਜਿਹੜਾ ਬਣਾਉਂਦੇ ਉਹ ਘੱਟ ਫਰਾਈ ਹੁੰਦਾ ਪਰ ਮੈਂ ਜ਼ਿਆਦਾ ਫਰਾਈ ਕਰਕੇ ਖਾਣਾ ਖਾਂਦੀ ਹਾਂ ਤਾਂ ਕਰਕੇ ਮੈਂ ਉਸ ਕੜਾਹੀ 'ਚ ਦੁਬਾਰਾ ਖਾਣਾ ਬਣਾ ਕੇ ਖਾਂਦੀ ਹਾਂ ਇਸ ਤਰ੍ਹਾਂ ਇਹ ਸਾਡੀ ਰਸੋਈ ਦੀ ਅਸੀਂ ਦੇਖਭਾਲ ਕਰਦੇ ਹਾਂ ਅਤੇ ਜਿਹੜੀ ਇਹ ਦੋ ਚੀਜ਼ਾਂ ਨੇ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਨੇ